ਜੀ ਹਾਂ ਅਸੀਂ ਸੈਲਾਨੀਆਂ ਨਾਲ਼ ਗੱਲਬਾਤ ਕਰਨਾ ਬਹੁਤ ਹੀ ਜ਼ਿਆਦਾ ਮਾਤਰਾ ਦੇ ਵਿੱਚ ਪਸੰਦ ਕਰਦੇ ਹਾਂ ਅਤੇ ਸਾਨੂੰ ਉਹਨਾਂ ਨਾਲ਼ ਗੱਲਬਾਤ ਕਰਕੇ ਬਹੁਤ ਹੀ ਵਧੀਆ ਮਹਿਸੂਸ ਹੁੰਦਾ ਹੈ ਕਿਉਂਕਿ ਜੇਕਰ ਗੱਲ ਕੀਤੀ ਜਾਵੇ ਤਾਂ ਸਾਡਾ ਇਸ ਦੇ ਨਾਲ਼ ਗਿਆਨ ਦੇ ਵਿੱਚ ਹੀ ਬਹੁਤ ਹੀ ਵਧੀਆ ਵਾਧਾ ਹੁੰਦਾ ਹੈ ਅਤੇ ਇਸ ਦੇ ਨਾਲ਼ ਸਾਡਾ ਦਿਮਾਗ਼ ਵੀ ਤੇਜ਼ ਹੁੰਦਾ ਹੈ ਕਿਉਂਕਿ ਸਾਰੇ ਸੈਲਾਨੀ ਜੇਕਰ ਅਸੀਂ ਕਿਸੀ ਵੀ ਟੂਰਿਸਟ ਬਸ ਜਹਾਜ਼ ਜਾਂ ਹੋਰ ਵੀ ਕਿਸੀ ਤਰ੍ਹਾਂ ਦੀ ਚੀਜ਼ ਦੇ ਵਿੱਚ ਜਾਈਏ ਤਾਂ ਉੱਥੋਂ ਵੱਖ ਵੱਖ ਜਗ੍ਹਾ ਤੋਂ ਟੂਰ ਸੈਲਾਨੀ ਆਏ ਹੁੰਦੇ ਹਨ ਅਤੇ ਉਹ ਸਾਨੂੰ ਵੱਖ ਵੱਖ ਚੀਜ਼ਾਂ ਬਾਰੇ ਦੱਸਦੇ ਹਨ ਜਿਸ ਦੇ ਨਾਲ਼ ਸਾਡੇ ਅੰਦਰ ਬਹੁਤ ਸਾਰਾ ਗਿਆਨ ਇਕੱਠਾ ਹੁੰਦਾ ਹੈ ਅਤੇ ਉਸਦੇ ਨਾਲ਼ ਸਾਡਾ ਦਿਮਾਗ ਤੇਜ਼ ਹੁੰਦਾ ਹੈ ਅਤੇ ਜਿਸ ਦੇ ਨਾਲ਼ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਵਿੱਚ ਵਾਧਾ ਹੁੰਦਾ ਹੈ